ਮੈਂ ਇਹ ਜਾਣਦਾ ਹਾਂ ਕਿ ਪ੍ਰਚੂਨ ਥੋਕ ਬਾਜ਼ਾਰਾਂ ਬਾਰੇ ਅਤੇ ਸਬਜ਼ੀਆਂ ਦੀਆਂ ਜੋ ਰੇਟ ਮਾਰਕਿਟ ਤੋਂ ਕਿਵੇਂ ਵੱਧਦੀਆਂ ਕਿਵੇਂ ਘੱਟਦੀਆਂ ਮੈਂ ਔਨਲਾਈਨ ਖਰੀਦਦਾਰੀ ਬਾਰੇ ਵੀ ਜਾਣਦਾ ਹਾਂ ਦੇਖੋ ਸਾਡੇ ਸਰਹਿੰਦ ਸ਼ਹਿਰ ਦੇ ਵਿੱਚ ਬਹੁਤ ਹੀ ਪ੍ਰਚੂਨ ਜਾਂ ਦੁਕਾਨਾਂ ਹਨ ਅਤੇ ਸਬਜ਼ੀ ਮੰਡੀ ਵੀ ਲੱਗਦੀ ਹੈ ਸਬਜ਼ੀਆਂ ਦੀਆਂ ਕੀਮਤਾਂ ਮੌਸਮ ਦੇ ਅਨੁਸਾਰ ਚਲਦੀਆਂ ਰਹਿੰਦੀਆਂ ਹਨ ਘੱਟਦੀਆਂ ਵੱਧਦੀਆਂ ਰਹਿੰਦੀਆਂ ਹਨ ਜੇਕਰ ਸਬਜ਼ੀ ਮੌਸਮ ਦੇ ਅਨੁਸਾਰ ਹੁੰਦੀ ਹੈ ਤਾਂ ਉਹ ਸਸਤੀ ਹੁੰਦੀ ਹੈ ਅਗਰ ਜੇ ਉਹ ਸਬਜ਼ੀ ਦਾ ਮੌਸਮ ਨਹੀਂ ਹੁੰਦਾ ਤਾਂ ਉਹ ਫਿਰ ਵੀ ਸਬਜ਼ੀ ਬਾਜ਼ਾਰ ਦੇ ਵਿੱਚ ਵੇਚੀ ਜਾਂਦੀ ਹੈ ਤਾਂ ਉਸਦਾ ਰੇਟ ਬਹੁਤ ਹੀ ਜ਼ਿਆਦਾ ਹੁੰਦਾ ਹੈ ਔਨਲਾਈਨ ਖਰੀਦਦਾਰੀ ਦੇ ਵਿੱਚ ਅਸੀਂ ਮੰਗਵਾਉਂਦੇ ਕੁਛ ਹਾਂ ਅਤੇ ਜੋ ਸਾਨੂੰ ਪਾਰਸਲ ਕਰਨ ਵਾਲਾ ਬੰਦਾ ਹੈ ਉਹ ਦੇ ਕੁਛ ਜਾਂਦਾ ਹੈ ਇਸ ਤਰ੍ਹਾਂ ਇੱਦਾਂ ਗੜਬੜ ਹੋ ਜਾਂਦੀ ਹੈ ਸਾਨੂੰ ਔਨਲਾਈਨ ਖਰੀਦਦਾਰੀ ਨਹੀਂ ਕਰਨੀ ਚਾਹੀਦੀ ਜੇ ਕਰਨੀ ਤਾਂ ਬਹੁਤ ਸੋਚ ਸਮਝ ਕੇ ਬਹੁਤ ਘੱਟ ਕਰਨੀ ਚਾਹੀਦੀ ਹੈ ਕਰਿਆਨੇ ਦੀਆਂ ਦੁਕਾਨਾਂ ਦਾ ਵੀ ਰੇਟ ਘੱਟ ਘੱਟਦਾ ਵੱਧਦਾ ਰਹਿੰਦਾ ਹੈ ਸਬਜ਼ੀਆਂ ਦਾ ਵੀ ਘੱਟਦਾ ਵੱਧਦਾ ਰਹਿੰਦਾ ਹੈ ਬਾਜ਼ਾਰਾਂ ਦੇ ਵਿੱਚ ਰੇਟ ਅਕਸਰ ਹੀ ਘੱਟਦੇ ਵੱਧਦੇ ਰਹਿੰਦੇ ਹਨ ਔਨਲਾਈਨ ਖਰੀਦਦਾਰੀ ਸਾਨੂੰ ਨਹੀਂ ਕਰਨੀ ਚਾਹੀਦੀ ਇਹ ਸਾਡੇ ਲਈ ਹਾਨੀਕਾਰਕ ਸਾਬਤ ਹੁੰਦੀ ਹੈ ਇਸ ਨਾਲ਼ ਸਾਡੇ ਪੈਸੇ ਹੀ ਬਰਬਾਦ ਹੁੰਦੇ ਹਨ ਹੋਰ ਹੋਰ ਕੁਝ ਨਹੀਂ ਹੁੰਦਾ ਕੋਈ ਕੋਈ ਔਨਲਾਈਨ ਖ ਖਰੀਦਦਾਰੀ ਦੀ ਜਿਹੜੀ ਚੀਜ਼ ਹੈ ਉਹ ਜ਼ਿਆਦਾ ਵਧੀਆ ਨਿਕਲਦੀ ਹੈ